ਦੋ ਸੌ ਚਾਲੀ ਪੰਦਰਾਂ ਹਜ਼ਾਰ ਛੇ ਸੌ ਅੱਸੀ ਨੱਬੇ ਹਜ਼ਾਰ ਇੱਕ ਸੌ ਚਾਲੀ ਚਾਰ ਲੱਖ ਪੈਂਤੀ ਹਜ਼ਾਰ ਤਿੰਨ ਸੌ ਅੱਠ ਲੱਖ ਤੇਤੀ ਹਜ਼ਾਰ ਸੱਤ ਸੌ ਦਸ